ਹਾਂ ਮੈਂ ਸਪੋਟੀਫਾਈ ਸੰਗੀਤ ਸਟੀਮਿੰਗ ਸੇਵਾ ਦੀ ਵਰਤੋਂ ਕੀਤੀ ਹੈ ਜਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਇਸਦਾ ਆਨੰਦ ਲਿਆ ਹੈ ਮੈਂ ਪਿਛਲੇ ਦੋ ਤਿੰਨ ਸਾਲਾ ਤੋਂ ਸਪੋਟੀਫਾਈ ਦੀ ਸਟੀਮਿੰਗ ਕਰ ਰਹੀ ਹਾਂ ਇਹ ਸਟੀਮਿੰਗ ਸਪੋਟੀਫਾਈ ਦੀ ਸਟੀਮਿੰਗ ਭੌਤਿਕ ਸੀ ਡੀ ਜਾਂ ਫਿਰ ਔਨਲਾਈਨ ਸੰਗੀਤ ਨਾਲੋਂ ਬਹੁਤ ਹੀ ਜ਼ਿਆਦਾ ਬਿਹਤਰ ਹੈ ਕਿਉਂਕਿ ਅਗਰ ਕਦੀ ਆਪਾਂ ਸੀ ਡੀ ਖਰੀਦਣ ਲਈ ਜਾਣਾ ਹੋਵੇ ਤਾਂ ਕਦੀ ਕਦੀ ਆਪਾਂ ਨੂੰ ਸੀ ਡੀ ਨਹੀਂ ਮਿਲਦੀ ਨਾਲ ਆਪਣਾ ਟਾਈਮ ਵੀ ਬਰਬਾਦ ਹੁੰਦਾ ਹੈ ਅਤੇ ਔਨਲਾਈਨ ਸੰਗੀਤ ਦਾ ਇਹ ਹੈ ਕਿ ਕਦੀ ਕਦੀ ਜਿਹੜਾ ਗਾਣਾ ਆਪਾਂ ਨੂੰ ਚਾਹੀਦਾ ਹੈ ਉਹ ਨਹੀਂ ਮਿਲਦਾ ਜਾਂ ਫਿਰ ਉਹ ਡਾਊਨਲੋਡ ਨਹੀਂ ਹੁੰਦਾ ਕਦੀ ਕਦੀ ਕੋਈ ਐਰਰ ਆ ਜਾਂਦਾ ਹੈ ਜਾਂ ਫਿਰ ਜਿਹੜੀ ਗਾਣੇ ਦੀ ਸੰਗੀਤ ਦੀ ਕੁਆਲਿਟੀ ਹੈ ਉਹ ਕਦੀ ਕਦੀ ਚੰਗੀ ਨਹੀਂ ਹੁੰਦੀ ਕਦੀ ਕਦੀ ਉਹਦੇ ਵਿੱਚ ਖੜ ਖੜ ਦੀ ਆਵਾਜ਼ ਆਉਂਦੀ ਹੈ ਜਦੋਂ ਆਪਾਂ ਔਨਲਾਈਨ ਸੰਗੀਤ ਡਾਊਨਲੋਡ ਕਰਦੇ ਹਾਂ ਕਦੀ ਕਦੀ ਜਿਹੜਾ ਔਨਲਾਈਨ ਸੰਗੀਤ ਤਾਂ ਆਪਾਂ ਡਾਊਨਲੋਡ ਕੀਤਾ ਹੋਇਆ ਹੁੰਦਾ ਵਾ ਉਹ ਕਦੀ ਕਦੀ ਚੱਲਦਾ ਨਹੀਂ ਆ ਜਾਂ ਫਿਰ ਕਦੀ ਕਦੀ ਵਿੱਚ ਹੀ ਚੱਲਦਾ ਹੋਇਆ ਰੁਕ ਜਾਂਦਾ ਹੈ ਇੱਦਾਂ ਹੀ ਭੌਤਿਕ ਸੀਡੀਆਂ ਨੇ ਅੱਜ ਦੇ ਟਾਈਮ ਵਿੱਚ ਤਾਂ ਵੈਸੇ ਵੀ ਜ਼ਿਆਦਾ ਭੌਤ ਭੌਤਿਕ ਸੀਡੀਆਂ ਕੋਈ ਵਰਤਦਾ ਨਹੀਂ ਹੈ ਜ਼ਿਆਦਾਤਰ ਲੋ ਲੋਕ ਜਿਹੜੀ ਚੀਜ਼ ਨਾਲ ਲਾਈਫ ਜ਼ਿਆਦਾ ਕੰਫਰਟੇਬਲ ਹੁੰਦੀ ਹੈ ਉਹੀ ਹੀ ਜ਼ਿਆਦਾਤਰ ਲੋਕ ਲੈਣ ਦੀ ਸੋਚਦੇ ਨੇ ਸਪੋਟੀਫਾਈ ਨਾਲ ਆਪਾਂ ਬੈਠ ਕੇ ਕਿਤੇ ਵੀ ਸਪੋਟੀਫਾਈ ਦੀ ਸਟੀਮਿੰਗ ਦੀ ਜਿਹੜੀ ਸੇਵਾ ਉਹਦੀ ਆਪਾਂ ਵਰਤੋਂ ਕਿਤੇ ਵੀ ਕਰ ਸਕਦੇ ਹਾਂ ਜਿਹੜਾ ਵੀ ਗਾਣਾ ਆਪਾਂ ਸੁਣਨਾ ਚਾਹੁੰਦੇ ਹਾਂ ਹਰ ਤਰ੍ਹਾਂ ਦਾ ਗਾਣਾ ਉਹਦੇ 'ਤੇ ਮੌਜੂਦ ਹੁੰਦਾ ਹੈ ਚਾਹੇ ਉਹ ਹਿੰਦੀ ਹੋਵੇ ਪੰਜਾਬੀ ਹੋਵੇ ਅੰਗਰੇਜ਼ੀ ਹੋਵੇ ਜਾਂ ਫਿਰ ਅੱਜ ਦੇ ਟਾਈਮ ਵਿੱਚ ਹਰਿਆਣਵੀ ਅਤੇ ਬਿਹਾਰੀ ਗਾਣੇ ਵੀ ਹੁੰਦੇ ਹਨ ਉਹਦੇ 'ਤੇ ਜ਼ਿਆਦਾਤਰ ਅਗਰ ਕਿਸੇ ਨੇ ਕੋਈ ਵਰਕਆਊਟ ਕਰਦੇ ਟਾਈਮ ਗਾਣਾ ਸੁਣਨਾ ਹੈ ਤਾਂ ਉਹ ਸੁਣ ਸਕਦਾ ਹੈ ਕੋਈ ਵਿਆਹ ਸ਼ਾਦੀ ਜਾਂ ਘਰ ਨੋਰਮਲ ਕੋਈ ਫੰਕਸ਼ਨ ਹੈ ਤਾਂ ਉਹ ਸਪੀਕਰ ਨਾਲ ਆਪਣਾ ਫੋਨ ਕਨੈਕਟ ਕਰਕੇ ਕੋਈ ਵੀ ਗਾਣਾ ਆਪਣੀ ਮਨਪਸੰਦ ਦਾ ਵਜਾ ਸਕਦੇ ਹਨ ਇਸ ਕਰਕੇ ਜਿਹੜੀ ਸਟੀਮਿੰਗ ਸੇਵਾ ਹੈ ਸਪੋਟੀਫਾਈ ਦੀ ਉਹ ਬਹੁਤ ਹੀ ਜ਼ਿਆਦਾ ਬਿਹਤਰ ਹੈ ਸੀ ਡੀ ਜਾਂ ਫਿਰ ਔਨਲਾਈਨ ਸੰਗੀਤ ਨਾਲੋਂ ਬਹੁਤ ਹੀ ਜ਼ਿਆਦਾ ਜ਼ਿੰਦਗੀ ਨੂੰ ਕੰਫਰਟੇਬਲ ਕਰਦੀ ਹੈ ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ ਜਾ ਕੇ ਸੀ ਡੀ ਲੱਭਣੀ ਨਹੀਂ ਪੈਂਦੀ ਆਪਣੀ ਪਸੰਦ ਦਾ ਗਾਣਾ ਤੁਸੀਂ ਕਿਤੇ ਵੀ ਬਹਿ ਕੇ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਸੁਣ ਸਕਦੇ ਹੋ ਉਹਦਾ ਆਨੰਦ ਲੈ ਸਕਦੇ ਹੋ